ਮੈਂ ਡਰੋਇੰਗ ਕਰਨੀ ਆਪਣੇ ਸਕੂਲ ਵਿੱਚ ਸ਼ੁਰੂ ਕੀਤੀ ਸੀ ਮੇਰੇ ਅਧਿਆਪਕ ਨੇ ਸਾਨੂੰ ਘਰ ਦੀ ਤਸਵੀਰ ਬਣਾਉਣੀ ਸਿਖਾਈ ਸੀ ਪਹਿਲਾਂ ਇਹ ਮੈਨੂੰ ਬਹੁਤ ਔਖੀ ਲੱਗੀ ਪਰ ਆਪਣੇ ਅਧਿਆਪਕ ਦੀ ਮਦਦ ਨਾਲ ਮੈਂ ਉਹ ਡਰੋਇੰਗ ਬਣਾ ਲਈ ਅਤੇ ਮੇਰੇ ਅਧਿਆਪਕ ਨੇ ਮੇਰੀ ਤਾਰੀਫ ਕੀਤੀ ਕਿਉਂਕਿ ਜਮਾਤ ਵਿੱਚ ਸਭ ਤੋਂ ਵਧੀਆ ਡਰੋਇੰਗ ਮੇਰੀ ਸੀ ਇਸ ਚੀਜ਼ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਇਸ ਤੋਂ ਬਾਅਦ ਡਰੋਇੰਗ ਵਿੱਚ ਮੇਰੀ ਰੁਚੀ ਵੱਧ ਗਈ ਅਤੇ ਮੈਂ ਹੋਰ ਕਈ ਤਰ੍ਹਾਂ ਦੀਆਂ ਤਸਵੀਰਾਂ ਬਣਾਉਣੀਆ ਸ਼ੁਰੂ ਕਰ ਦਿੱਤੀਆਂ ਹੁਣ ਮੈਂ ਡਰੋਇੰਗ ਵਿੱਚ ਮਾਹਿਰ ਹਾਂ ਅਤੇ ਇਹ ਮੈਨੂੰ ਬਹੁਤ ਖੁਸ਼ੀ ਦਿੰਦੀ ਹੈ ਧੰਨਵਾਦ